ਇੱਕ ਖੂਹ 'ਚੋਂ ਪਾਣੀ ਪਹਿਲਾਂ ਲੱਜ ਗੇਰ ਕੇ ਬਾਲਟੀ ਨਾਲ਼ ਖਿੱਚਦੀਆਂ ਤੀਆਂ ਪਿਛਲੇ ਜ਼ਮਾਨੇ ਦੇ ਵਿੱਚ ਜਦੋਂ ਖੂਹ ਖੂਹਾਂ ਦੇ ਵਿੱਚ ਆਮ ਮਾਤਰ ਪਾਣੀ ਰਹਿੰਦਾ ਸੀ ਉਹਦੋਂ ਬਾਅਦ ਫਿਰ ਬਾ ਜਿਨ੍ਹਾਂ ਨੇ ਵਾਹੀਯੋਗ ਜ਼ਮੀਨਾਂ ਨੂੰ ਆਪਣਾ ਪਾਣੀ ਦੇਣਾ ਹੁੰਦਾ ਸੀਗਾ ਉਹ ਟਿੰਡਾਂ ਰਾਹੀਂ ਇੱਕ ਚੈਨ ਹੁੰਦੀ ਸੀਗੀ ਲੋਹੇ ਦੀ ਉਹਨਾਂ ਨੂੰ ਇੱਕ ਬਾਲਟੀ ਟਾਈਪ ਟਿੰਡ ਕਹਿ ਦਿੰਦੇ ਹਾਂ ਉਹਨੂੰ ਉਹ ਬਣਾਈ ਵੀ ਹੁੰਦੀ ਸੀ ਉਹ ਬਲਦਾਂ ਨਾਲ਼ ਪੁਲ਼ੀ ਦੇ ਹਿਸਾਬ ਦੇ ਨਾਲ਼ ਬਲਦ ਆਲ਼ੇ ਦੁਆਲ਼ੇ ਘੁੰਮਦੇ ਸੀਗੇ ਅਤੇ ਚੱਲਦੀਆਂ ਤੀਆਂ ਉਹਦੋਂ ਬਾਅਦ ਪਾਣੀ ਕੰਟੀਨਿਊ ਚੱਲਦਾ ਰਹਿੰਦਾ ਸੀ ਇੱਕ ਸੌ ਦੋ ਇੱਕ ਸੌ ਅੱਠ ਦੀ ਚੈਨ ਹੁੰਦੀ ਸੀਗੀ ਉਹ ਉਹ ਤੋਂ ਬਾਅਦ ਅੱਜ ਕੱਲ੍ਹ ਦਾ ਜਿਹੜਾ ਇਲੈਕਟ੍ਰੀਕਲ ਜ਼ਮਾਨਾ ਹੈ ਇਹਦੇ ਵਿੱਚ ਵੱਧ ਤੋਂ ਵੱਧ ਹਾਰਸਪਾਵਰ ਦੀਆਂ ਇਲੈਕਟ੍ਰੀਕਲ ਸਵਰਸੀਬਲ ਮੋਟਰਾਂ ਆ ਗਈਆਂ ਅਲੱਗ ਅਲੱਗ ਕੋਪਨੀਆਂ ਦੀਆਂ ਜਿਹੜੀਆਂ ਕਿ ਸੱਤ ਸੌ ਅੱਠ ਸੌ ਬਾਰ੍ਹਾਂ ਸੌ ਪੰਦਰ੍ਹਾਂ ਸੌ ਫੁੱਟ ਤੋਂ ਪਾਣੀ ਖਿੱਚਦੀਆਂ ਅਤੇ ਕੰਟੀਨਿਊ ਬਿਜਲੀ ਰਾਹੀਂ ਪਾਣੀ ਆਪਾਂ ਦੇ ਸਕਦੇ ਹਾਂ